ਅੱਜ ਕੱਲ੍ਹ ਔਨਲਾਈਨ ਬਹੁਤ ਸਾਰੀਆਂ ਐਪਸ ਚੱਲ ਰਹੀਆਂ ਨੇ ਜਿਵੇਂ ਜਿਨ੍ਹਾਂ ਦੇ ਥਰੂ ਆਪਾਂ ਕਿਸੇ ਨੂੰ ਵੀ ਆਪਣੇ ਘਰ ਬੁਲਾ ਕੇ ਅਤੇ ਕੋਈ ਵੀ ਸੈਟਿੰਗ ਵਗੈਰਾ ਜਿਹੜੀ ਆ ਉਹ ਚੀਜ਼ ਦੀ ਕਰਵਾ ਸਕਦੇ ਹਾਂ ਜਿਵੇਂ ਆਪਾਂ ਟਾਸਕਰੈਬਿਟ ਦੀ ਗੱਲ ਕਰੀਏ ਉਹਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਵੇਂ ਕਿ ਤੁਸੀਂ ਆਪਣਾ ਫਰਨੀਚਰ ਅਸੈਂਬਲ ਕਰਵਾ ਸਕਦੇ ਹੋ ਅਤੇ ਮੈਂ ਰੀਸੈਂਟਲੀ ਆਪਣੀ ਟੀ ਵੀ ਮੰਗਵਾਇਆ ਸੀਗਾ ਮੈਂ ਉਹਨੂੰ ਬਾਏ ਕੀਤਾ ਅਤੇ ਮੈਂ ਉਹਨਾਂ ਨੂੰ ਫ਼ੋਨ ਕਰਕੇ ਕਿਹਾ ਕਿ ਤੁਸੀਂ ਮਤਲਬ ਮੇਰੇ ਟੀ ਵੀ ਜਿਹੜਾ ਉਹਨੂੰ ਮਤਲਬ ਇੱਕ ਵਾਰ ਅਸੈਂਬਲ ਕਰਕੇ ਅਤੇ ਲਗਾ ਜਾਉ ਅਤੇ ਉਹ ਉਹਨਾਂ ਦਾ ਇੱਕ ਪਰਸਨ ਉਹਨਾਂ ਨੇ ਭੇਜ ਦਿੱਤਾ ਸੀ ਮੇਰੇ ਘਰ ਅਤੇ ਉਹ ਮੇਰੇ ਘਰ ਆਇਆ ਅਤੇ ਉਹਨੇ ਆ ਕੇ ਜਿਹੜੀ ਟੀ ਵੀ ਦੀ ਅਸੈਂਬਲਿੰਗ ਹੈ ਉਹ ਸ਼ੁਰੂ ਕੀਤੀ ਉਹਨੇ ਅਸੈਂਬਲਿੰਗ ਕੀਤੀ ਅਤੇ ਅਸੈਂਬਲ ਵਗੈਰਾ ਕਰ ਗਿਆ ਲੇਕਿਨ ਮੇਰਾ ਜਿਹੜਾ ਐਕਸਪੀਰੀਅਸ ਹੈਗਾ ਉਹਨਾਂ ਨਾਲ ਉਹ ਐਨਾ ਵਧੀਆ ਨਹੀਂ ਗਿਆ ਔਰ ਉਹ ਜਦੋਂ ਇੱਕ ਤਾਂ ਉਹ ਮਤਲਬ ਉਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਸੇਮ ਡੇਅ ਤੁਹਾਨੂੰ ਜਿਹੜੀ ਆ ਉਹ ਫੈਸਿਲਿਟੀ ਮਿਲ ਜਾਵੇਗੀ ਅਤੇ ਜਿਹੜਾ ਉਸ ਦਿਨ ਨੂੰ ਮਤਲਬ ਮਤਲਬ ਸੇਮ ਡੇਅ ਪਰਸਨ ਆਇਆ ਲੇਕਿਨ ਉਹ ਕਾਫੀ ਲੇਟ ਆਇਆ ਸਾਢੇ ਸੱਤ ਰਾਤ ਦੇ ਅੱਠ ਵੱਜ ਰਹੇ ਸੀ ਅਤੇ ਉਹ ਆ ਕੇ ਮਤਲਬ ਜਦੋਂ ਉਹਨੇ ਪਹਿਲੇ ਥੋੜ੍ਹਾ ਕੰਮ ਆਪਣਾ ਸਟਾਰਟ ਕੀਤਾ ਅਤੇ ਉਹ ਕਹਿੰਦਾ ਕਿ ਐਕਚੁਅਲ ਇੱਥੇ ਮਤਲਬ ਉਹਨੂੰ ਕਹਿੰਦਾ ਕਿ ਮੇਰੇ ਕੋਲ ਪੂਰੀ ਐਕਸੈਸਰੀਜ਼ ਨਹੀਂ ਹੈਗੀਆਂ ਅਤੇ ਉਹ ਦੇਖ ਗਿਆ ਸਾਰੀ ਜਗ੍ਹਾ ਵਗੈਰਾ ਲੋਕੇਸ਼ਨ ਵਗੈਰਾ ਚੈੱਕ ਕਰ ਗਿਆ ਅਤੇ ਉਹ ਕਹਿੰਦਾ ਮੈਂ ਕੱਲ੍ਹ ਫੇਰ ਆਵਾਂਗਾ ਉਹ ਥੋੜ੍ਹੀ ਸੈਟਿੰਗ ਕਰ ਗਿਆ ਬਾਕੀ ਉਹ ਪੈਂਡਿੰਗ ਛੱਡ ਗਿਆ ਫਿਰ ਉਹ ਨੈਕਸਟ ਡੇ ਆਇਆ ਫਿਰ ਉਹਨੇ ਟੀ ਵੀ ਲਗਾਇਆ ਫਿਰ ਉਹਨੇ ਉੱਪਰ ਡਿਸ਼ ਟੀ ਵੀ ਵੀ ਮੈਂ ਨਾਲ ਅਟੈਚ ਕਰਵਾਇਆ ਸੀ ਫਿਰ ਉਹਨੇ ਉਹਦੀ ਵੀ ਸੈਟਿੰਗ ਕੀਤੀ ਅਤੇ ਉਹਨੇ ਮਤਲਬ ਉਹਦੀ ਸੈਟਿੰਗ ਵਗੈਰਾ ਤਾਂ ਚਲੋ ਵਧੀਆ ਕਰ ਦਿੱਤੀ ਲੇਕਿਨ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਸੀਗਾ ਮੈਨੂੰ ਉਹਨੂੰ ਕਿੰਨੇ ਹੀ ਮਤਲਬ ਕਿੰਨੇ ਫ਼ੋਨ ਕਰਨੇ ਪੈਣੇ ਕ ਫ਼ੋਨ ਕਰ ਕਰਕੇ ਉਹਨੂੰ ਸੱਦਣਾ ਪਿਆ ਕਿ ਵੀ ਤੁਸੀਂ ਆ ਜਾਉ ਆ ਜਾਉ ਆ ਜਾਉ ਕਿਉਂਕਿ ਉਹਦੇ 'ਚ ਉਹਨਾਂ ਨੇ ਮੇਰੇ ਕੋਲੋਂ ਪੇਮੈਂਟ ਜਿਹੜੀ ਆ ਨਾ ਉਹ ਪਹਿਲਾਂ ਹੀ ਐਡਵਾਂਸ ਪਹਿਲਾਂ ਲਿਤੀ ਸੀਗੀ ਅੱਧੀ ਅਤੇ ਮੈਂ ਹਾਫ ਹੀ ਉਹਨਾਂ ਦੀ ਪੇਮੈਂਟ ਕਰਨੀ ਸੀ ਅਤੇ ਇਸ ਕਰਕੇ ਮੈਨੂੰ ਹੁਣ ਲੱਗਦਾ ਹੈ ਕਿ ਜਿਹੜਾ ਇੱਦਾਂ ਮਤਲਬ ਔਨਲਾਈਨ ਫਸ ਜਿਹੜੇ ਐਪਸ ਚੱਲਦੇ ਆ ਜਿਹਦੇ ਥਰੂ ਸਮਾਨ ਵਗੈਰਾ ਮੰਗਵਾਇਆ ਜਾਂਦਾ ਉਹ ਐਨੀਆਂ ਰਿਲਾਈਬਲ ਸੋਰਸ ਨਹੀਂ ਮੈਨੂੰ ਐਨੀਆਂ ਰਿਲਾਈਬਲ ਸੋਰਸ ਨਹੀਂ ਲੱਗਦੀਆਂ